ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਵੈਸੇ ਤਾਂ ਸਰ ਦੇਖੋ ਸਾਡੇ ਕਪੂਰਥਲੇ 'ਚ ਸਾਰੇ ਹੀ ਸਕੂਲ ਵੈਸੇ ਤਕਰੀਬਨ ਵਧੀਆ ਹੀ ਆ ਪਰ ਕੁਝ ਇੱਥੇ ਦੇ ਸਪੈਸ਼ਲ ਸਕੂਲ ਆ ਜੀ ਜਿਵੇਂ ਐਮ ਜੀ ਐਮ ਸਕੂਲ ਆ ਜੀ ਇੱਥੇ ਬਹੁਤ ਵਧੀਆ ਸਕੂਲ ਹੈ ਜੀ ਬਹੁਤ ਵਧੀਆ ਰਿਜਲਟ ਆਉਂਦਾ ਉੱਥੇ ਦਾ ਹਰ ਬ ਸਾਲ ਹਾਂਜੀ ਪ੍ਰੋਪਰ ਟੀਚਰਸ ਆ ਜੀ ਉੱਥੇ ਸਾਰੇ ਟੀਚਰਸ ਬੱਚਿਆਂ ਦੇ ਪ੍ਰੋਪਰ ਧਿਆਨ ਦਿੰਦੇ ਆ ਬੱਚਿਆਂ ਨੂੰ ਸਹੀ ਢੰਗ ਤਰੀਕੇ ਨਾਲ ਗਾਈਡ ਕਰਦੇ ਆ ਜੀ ਉੱਥੇ ਨਾ ਸਕੂਲ 'ਚ ਬੱਚਿਆਂ ਨੂੰ ਪ੍ਰਿੰਸੀਪਲ ਵੀ ਵੈਸੇ ਸਾਰਾ ਸਟਾਫ਼ ਬੜਾ ਕਾਰਪੋਰੇਟਿਵ ਹੈ ਜੀ ਮੰਥਲੀ ਪੇਰੈਂਟਸ ਮੀਟਿੰਗ ਵੀ ਅਰੇਨਜ ਕਰੀਆਂ ਜਾਂਦੀਆਂ ਜਿਹਦੇ 'ਚ ਬੱਚਿਆਂ ਦੀਆਂ ਸਾਰੀਆਂ ਕਮੀਆਂ ਪੇਸ਼ੀਆਂ ਪੇਰੈਂਟਸ ਨੂੰ ਦੱਸੀਆਂ ਜਾਂਦੀਆਂ ਕਿਵੇਂ ਦੀ ਪਰਫੋਰਮੈਂਸ ਕਰਦੇ ਆ ਬੱਚੇ ਸਾਰਾ ਦੱਸਿਆ ਜਾਂਦਾ ਹਾਂਜੀ ਬਾਕੀ ਸਾਰਾ ਸਟਾਫ ਵਧੀਆ ਜੀ ਇੱਕ ਇੱਥੇ ਸੈਨਿਕ ਸਕੂਲ ਵੀ ਹੈ ਜੀ ਹਾਂ ਜੀ ਉੱਥੇ ਵੀ ਕਾਫ਼ੀ ਵਧੀਆ ਸਟਾਫ਼ ਹੈ ਸਾਰਾ ਕੁਛ ਵਧੀਆ ਐਨ ਸੀ ਸੀ ਵੀ ਹੈਗੀ ਆ ਜੀ ਉੱਥੇ ਹੋਰ ਵੀ ਕਈ ਤਰ੍ਹਾਂ ਦੀਆਂ ਸਪੋਰਟਸ ਐਕਟੀਵਿਟੀਜ ਕਰੀਆਂ ਜਾਂਦੀਆਂ ਹਾਂਜੀ ਜਿਹੜੇ ਸਟੂਡੈਂਟਸ ਨਾ ਦੇਖੋ ਜੀ ਇਹ ਦੋਨੋਂ ਸੀ ਬੀ ਐਸ ਈ ਬੋਰਡ ਹੈ ਜੀ ਹਾਂਜੀ ਇੱਥੇ ਨਾ ਬਾਕੀ ਪੰਜਾਬ ਬੋਰਡ 'ਚ ਲਗਾਉਣੇ ਆ ਜੀ ਤੁਸੀਂ ਅੱਛਾ ਜੀ ਸੀ ਬੀ ਐਸ ਈ ਦਾ ਜੀ ਇਹ ਹੀ ਸਕੂਲ ਬੈਸਟ ਆ ਇਹ ਜਿਹੜਾ ਮੈਂ ਤੁਹਾਨੂੰ ਸੈਨਿਕ ਸਕੂਲ ਦੱਸ ਰਿਹਾ ਏ ਇਹ ਬਹੁਤ ਵਧੀਆ ਸਕੂਲ ਆ ਟੋਪ ਦਾ ਸਕੂਲ ਆ ਸਾਡੇ ਉਰੇ ਕਪੂਰਥਲੇ ਦਾ ਹਾਂਜੀ ਇੱਥੋਂ ਦੇ ਬੱਚਿਆਂ ਦੇ ਕਾਫ਼ੀ ਵਧੀਆ ਰੈਂਕ ਆਉਂਦੇ ਆ ਜੀ ਸਪੋਰਟਸ 'ਚ ਨੈਸ਼ਨਲ ਵੀ ਖੇਲ ਕੇ ਆਏ ਜੀ ਕੁਝ ਬੱਚੇ ਇੱਥੇ ਦੇ ਹਾਂਜੀ ਬਾਕੀ ਇੱਥੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈਗਾ ਜੇ ਤੁਸੀਂ ਪਾ ਬਾਈ ਚਾਂਸ ਪੰਜਾਬ ਬੋਰਡ 'ਚ ਲਗਾਉਣੇ ਪਏ ਤੁਹਾਨੂੰ ਬੱਚੇ ਤਾਂ ਉੱਥੇ ਵੀ ਸਟਾਫ ਵੈਸੇ ਕੋਆਪਰੇਟਿਵ ਏ ਆ ਸਾਰਾ ਵਧੀਆ ਸਟਾਫ ਆ ਜੀ

ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਭਾਅ ਜੀ ਕੋਈ ਚੱਕਰ ਨਹੀਂ ਜੀ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ

ਹਾਂਜੀ ਹਾਂਜੀ ਓਕੇ ਜੀ